ਹੈਲੋ ਪਲਵੀ ਮੈਂ ਮੈਂ ਤਾਨੀਆ ਬੋਲ ਰਹੀ ਹਾਂ ਮੈਂ ਤੁਹਾਨੂੰ ਪੁੱਛਣਾ ਸੀ ਕਿ ਜਿੱਦਾਂ ਹੁਣ ਮੇਰੀ ਐਜੂਕੇਸ਼ਨ ਕੰਪਲੀਟ ਹੋ ਗਈ ਹੈ ਅਤੇ ਮੈਂ ਫਰਦਰ ਸਟੱਡੀ ਲਈ ਅਡਮਿਸ਼ਨ ਲੈਣੀ ਆ ਤਾਂ ਮੈਂ ਕਿੱਥੇ ਲਵਾਂ ਕਿਵੇਂ ਮਤਲਬ ਜ਼ਿਆਦਾ ਬੈਸਟ ਆ ਬੇਅੰਤ ਕੋਲੇਜ ਹੋਰ ਕੋਲੇਜਾਂ ਨਾਲੋਂ ਹਾਂਜੀ ਹਾਂਜੀ ਅਤੇ ਜਿੱਦਾਂ ਮਤਲਬ ਫੀਸ ਵਗੈਰਾ ਇੱਕੋ ਦਮ ਦੇਣੀ ਪਊਗੀ ਸਕੋਲਰਸ਼ਿਪ ਵਗੈਰਾ ਹਾਂਜੀ ਠੀਕ ਹੈ ਅਤੇ ਤੁਸੀਂ ਤੁਹਾਡੇ ਕੋਲ ਟਾਈਮ ਹੋਊਗਾ ਤੁਸੀਂ ਮੇਰੇ ਨਾਲ ਅਗਲੇ ਮੰਡੇ ਚੱਲ ਸਕਦੇ ਹੋ ਨਾਲ ਮੇਰੇ ਚਲੋ ਠੀਕ ਆ ਫਿਰ ਤੁਸੀਂ ਮੇਰੇ ਨਾਲ ਅਗਲੇ ਮੰਡੇ ਰੈਡੀ ਰਿਹੋ ਮੈਂ ਤੁਹਾਨੂੰ ਕੋਲ ਕਰਾਂਗੀ ਅਤੇ ਤੁਸੀਂ ਮੈਨੂੰ ਬੱਸ ਸਟੈਂਡ ਆ ਕੇ ਮਿਲ ਲਿਓ ਅਤੇ ਅਸੀਂ ਫਿਰ ਇਕੱਠੇ ਚੱਲਾਂਗੇ ਠੀਕ ਆ ਓਕੇ ਬਾਏ